ਧਰਮ ਸਾਡੇ ਖੇਤਰ ਵਿੱਚ ਸੈਰ ਸਪਾਟੇ ਨੂੰ ਬਹੁਤ ਪ੍ਰਭਾਵਿਤ ਕਰਦਾ ਹੈ ਕਿਉਂਕਿ ਬਹੁਤ ਸਾਰੇ ਲੋਕ ਬਹੁਤ ਵਾਰੀ ਗਰਮੀ ਦੀਆਂ ਛੁੱਟੀਆਂ ਵਿੱਚ ਉਸ ਤਰ੍ਹਾਂ ਦੀ ਵਿਉਂਤ ਬਣਾਉਂਦੇ ਹਨ ਸੈਰ ਸਪਾਟੇ ਦੀ ਵਿਉਂਤ ਬਣਾਉਂਦੇ ਹਨ ਜਿਨ੍ਹਾਂ ਨਾਲ ਉਹਨਾਂ ਦਾ ਸੈਰ ਸਪਾਟਾ ਵੀ ਹੋ ਜਾਏ ਅਤੇ ਤੀਰਥ ਯਾਤਰਾ ਵੀ ਜਿਵੇਂ ਕਿ ਜਿਵੇਂ ਜਿਵੇਂ ਆਪਣੇ ਫਤਿਹਗੜ ਸਾਹਿਬ ਜ਼ਿਲ੍ਹੇ ਦੀ ਗੱਲ ਕਰਾਂ ਤਾਂ ਇੱਥੇ ਦੋ ਵੱਡੇ ਇਤਿਹਾਸਕ ਗੁਰਦੁਆਰੇ ਹਨ ਜਿੱਥੇ ਕਿ ਗੁਰੂ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਛੋਟੇ ਸਾਹਿਬਜ਼ਾਦਿਆਂ ਨੂੰ ਸ਼ਹੀਦ ਕੀਤਾ ਗਿਆ ਸੀ ਇੱਥੇ ਇੱਕ ਪੁਰਾਤਨ ਆਮ ਖਾਸ ਬਾਗ ਵੀ ਹੈ ਜੋ ਕਿ ਲਗਭਗ ਚਾਰ ਸੌ ਸਾਲ ਪੁਰਾਣਾ ਹੈ ਸੋ ਇਸ ਤਰ੍ਹਾਂ ਇੱਥੇ ਸ਼ਹੀਦੀ ਜੋੜ ਮੇਲਾ ਫਤਿਹਗੜ੍ਹ ਸਾਹਿਬ ਲੱਗਦਾ ਹੈ ਜੋ ਕਿ ਦਸੰਬਰ ਦੇ ਮਹੀਨੇ ਵਿੱਚ ਲੱਗਦਾ ਹੈ ਅਤੇ ਪੂਰੇ ਦੇਸ਼ ਭਰ ਤੋਂ ਲੋਕ ਇੱਥੇ ਆਉਂਦੇ ਹਨ ਦੂਜੀ ਗੱਲ ਇਹ ਕਿ ਬਹੁਤ ਵਾਰੀ ਅਸੀਂ ਉਹਨਾਂ ਥਾਵਾਂ ਚੁਣ ਦੀ ਚੋਣ ਕਰਦੇ ਹਾਂ ਜਿਵੇਂ ਕਿ ਗਰਮੀਆਂ ਦੀਆਂ ਛੁੱਟੀਆਂ ਲਈ ਪਹਾੜੀ ਇਲਾਕੇ ਵਿੱਚ ਜਾਣਾ ਜਿੱਥੇ ਕੋਈ ਕੋਈ ਨਾ ਕੋਈ ਇਤਿਹਾਸਕ ਤੀਰਥ ਅਸਥਾਨ ਜਾਂ ਇਤਿਹਾਸਕ ਗੁਰਦੁਆਰਾ ਵੀ ਹੋਵੇ ਤਾਂ ਕਿ ਗੁਰਦੁਆਰੇ ਦੇ ਦਰਸ਼ਨ ਵੀ ਹੋ ਸਕਣ ਅਤੇ ਸੈਰ ਸਪਾਟਾ ਵੀ ਹੋ ਸਕੇ ਦੂਜਾ ਸਾਡੇ ਪੰਜਾਬ ਵਿੱਚ ਅੰਮ੍ਰਿਤਸਰ ਸਾਹਿਬ ਵਿੱਚ ਸ੍ਰੀ ਹਰਿਮੰਦਰ ਸਾਹਿਬ ਹੈ ਅਤੇ ਉੱਥੇ ਵੀ ਹਰ ਰੋਜ਼ ਦੇਸ਼ ਭਰ ਤੋਂ ਲੋਕ ਆਉਂਦੇ ਰਹਿੰਦੇ ਹਨ